ਬਦਲਦੇ ਮੌਸਮ ਨਾਲ ਖੇਤਰ ਦੀ ਖੇਤੀ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਕਿਉਂਕਿ ਜਦੋਂ ਹੜ੍ਹ ਸੋਕਾ ਅਤੇ ਸਰਦੀਆਂ ਤੂਫ਼ਾਨ ਗੜ੍ਹੇ ਆਉਂਦੇ ਹਨ ਤਾਂ ਕਿਸਾਨਾਂ ਨੂੰ ਇਸ ਦਾ ਇਸਦੀ ਰੁਕਾਵਟ ਲਈ ਉਹ ਪਹਿਲਾਂ ਤੋਂ ਹੀ ਪ੍ਰਬੰਧ ਕਰਕੇ ਰੱਖਦੇ ਹਨ ਉਹ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਉਹਨਾਂ ਨੂੰ ਟਾਈਮ ਤੋਂ ਥੋੜਾ ਪਹਿਲਾਂ ਲਗਾ ਦਿੰਦੇ ਹਨ ਤਾਂ ਜੋ ਉਹ ਫਸਲਾਂ ਨੂੰ ਫਸਲਾਂ ਨੂੰ ਬਚਾ ਸਕਣ ਜੇਕਰ ਉਹ ਉਹ ਅਪਣੀਆਂ ਫਸਲਾਂ ਨੂੰ ਬਚਾ ਕੇ ਵਧੀਆ ਮੁਨਾਫ਼ਾ ਕਮਾਉਂਦੇ ਹਨ ਅਤੇ ਉਹ ਆਪਣੇ ਇਹਨਾਂ ਨਾਲ ਹੜ੍ਹਾਂ ਸੋਕਾ ਸਰਦੀਆਂ ਅਤੇ ਤੂਫਾਨ ਅਤੇ ਗੜਿਆਂ ਨਾਲ ਤਾਂ ਪਹਿਲਾਂ ਨਜਿੱਠ ਲੈਂਦੇ ਹਨ ਜਦੋਂ ਉਹ ਇਹਨਾਂ ਨੂੰ ਦੇਖਦੇ ਹਨ ਕਿ ਇਹਨਾਂ ਦੇ ਮੌਸਮ 'ਤੇ ਇਹਨਾਂ ਦੀ ਫਸਲ 'ਤੇ ਇਹ ਨੁਕਸਾਨ ਹੋਵੇਗਾ ਤਾਂ ਉਹ ਪਹਿਲਾਂ ਹੀ ਉਹਨਾਂ ਫਲਾਂ ਉਹਨਾਂ ਸਬਜ਼ੀਆਂ ਫਲਾਂ ਕਣਕਾਂ ਚੋਲਾਂ ਨੂੰ ਪਹਿਲਾਂ ਹੀ ਮਹੀਨੇ ਤੋਂ ਪਹਿਲਾਂ ਹੀ ਮੌਸਮ ਤੋਂ ਲਗਾ ਦਿੰਦੇ ਹਨ ਤਾਂ ਜੋ ਉਹਨਾਂ ਨੂੰ ਇਹਦਾ ਮੁ ਮੁਨਾਫ਼ਾ ਰੁਕਾਵਟ ਦੇ ਵਿੱਚ ਨਾ ਆ ਸਕਣ ਜਦੋਂ ਉਹ ਇਹ ਚੀਜ਼ਾਂ ਕਰਦੇ ਹਨ ਤਾਂ ਉਹਨਾਂ ਦੀ ਫਸਲ ਵੀ ਵਧੀਆ ਹੋ ਜਾਂਦੀ ਹੈ ਅਤੇ ਉਹਨਾਂ ਦੇਉ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਜੇਕਰ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਉਹਦੀ ਭਰਪਾਈ ਵੀ ਉਹ ਕਿਸੇ ਨਾ ਕਿਵੇਂ ਕਰਕੇ ਕਰ ਲੈਂਦੇ ਹਨ ਤਾਂ ਪਰ ਪਹਿ ਮੁੱਕਦੀ ਗੱਲ ਇਹ ਹੈ ਕਿ ਉਹ ਆਪਣੀ ਫਸਲ ਨੂੰ ਬਚਾਉਣ ਲਈ ਬਹੁਤ ਕੁਝ ਕਰਦੇ ਨੇ ਅਤੇ ਉਹ ਇਹਨਾਂ ਚੀਜ਼ਾਂ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰਕੇ ਰੱਖਦੇ ਹਨ ਕਿ ਉਹਨਾਂ ਦੀ ਫਸਲ ਨੂੰ ਕੋਈ ਨੁਕਸਾਨ ਨਾ ਹੋ ਸਕੇ